ਹਾਂਜੀ ਸਰ ਮੈਂ ਇੱਕ ਪੀਜ਼ਾ ਔਡਰ ਕਰਨਾ ਚਾਹੁੰਦੀ ਹਾਂ ਤੁਹਾਡੇ ਕੋਲ ਪੀਜ਼ੇ ਵਿੱਚ ਕਿਹੜੇ ਕਿਹੜੇ ਸਾਈਜ਼ ਹਨ ਮੈਂ ਇਹ ਜਾਣਨਾ ਚਾਹੁੰਦੀ ਹਾਂ ਮੈਂ ਇੱਕ ਪੀਜ਼ਾ ਔਡਰ ਕਰਨਾ ਹੈ ਜਿਹਦੇ ਵਿੱਚ ਕਿ ਜਿਹੜਾ ਉਹਦਾ ਬੇਸ ਹੈ ਉਹ ਜਿਹੜਾ ਵਧੀਆ ਹੋਣਾ ਚਾਹੀਦਾ ਸੋਫਟ ਹੋਣਾ ਚਾਹੀਦਾ ਹੈ ਉਹਦੇ ਉੱਪਰ ਮੈਂ ਐਕਸਟ੍ਰਾ ਚੀਜ਼ ਬਸਟ ਵੀ ਪਵਾਉਣਾ ਚਾਹਾਂਗੀ ਉਹਦੇ ਉੱਤੇ ਸ਼ਿਮਲਾ ਮਿਰਚਾਂ ਵੀ ਪਾ ਦਿਓ ਥੋੜ੍ਹੇ ਜਿਹੇ ਪਿਆਜ਼ ਵੀ ਪਾ ਦਿਓ ਔਲਿਵਜ਼ ਵੀ ਪਾਉਣਾ ਚਾਹਾਂਗੀ ਸੋਸ ਜਿਹੜੀ ਆ ਮਿਰਚਾਂ ਵਾਲੀ ਘੱਟ ਰੱਖਣੀ ਹੈ ਅਤੇ ਥੋੜ੍ਹੇ ਜਿਹੀ ਸੇਜਵਾਨ ਚਟਨੀ ਪਸੰਦ ਕਰਨਾ ਚਾਹਾਂਗੀ ਅਤੇ ਟੋਪਿੰਗਜ਼ ਥੋੜ੍ਹੀਆਂ ਮੈਂ ਜ਼ਿਆਦਾ ਪਸੰਦ ਕਰ ਕਰਨਾ ਚਾਹਾਂਗੀ ਅਤੇ ਪੀਜ਼ੇ ਦਾ ਬੇਸ ਥੋੜ੍ਹਾ ਸੋਫਟ ਹੋਣਾ ਚਾਹੀਦਾ ਹੈ ਤਾਂ ਜੋ ਈਜ਼ੀ ਨਾਲ਼ ਖਾਧਾ ਜਾਵੇ ਅਤੇ ਉਹਨੂੰ ਜ ਬੇਕ ਵੀ ਵਧੀਆ ਤਰੀਕੇ ਨਾਲ਼ ਕਰ ਦਿਓ ਅਤੇ ਤੁਹਾਡੇ ਰੈਸਟੋਰੈਂਟਸ ਦੇ ਵਿੱਚ ਜੇ ਔਲਿਵਜ ਮਿਲ ਜਾਣ ਔਲਿਵ ਦੀ ਉਪਲੱਬਧੀ ਹੋਵੇ ਤਾਂ ਜ਼ਰੂਰ ਉਸ ਵਿੱਚ ਐਡ ਕਰਿਓ ਅਤੇ ਮੈਂ ਆਪਣਾ ਇਹੀ ਔਡਰ ਫਾਈਨਲ ਕਰਦੀ ਹਾਂ